ਹੈਲੋ ਭਾਅ ਜੀ ਤੁਸੀਂ ਗੁਰਦਾਸਪੁਰ ਚੱਲੋਗੇ ਅਸੀਂ ਦੀਨਾ ਨਗਰੋਂ ਭਾਅ ਜੀ ਮੈਂ ਤਾਂ ਇਕੱਲਾ ਹੀ ਹਾਂ ਮੇਰਾ ਓਪਰੇਸ਼ਨ ਹੋਇਆ ਦਾ ਸੀ ਇਸ ਲਈ ਮੈਨੂੰ ਜ਼ਰੂਰੀ ਸੀ ਉੱਥੇ ਜਾਣਾ ਹਾਂਜੀ ਪੱਥਰੀ ਦਾ ਹੋਇਆ ਦਾ

ਭਾਅ ਜੀ ਵੀਹ ਰੁਪਏ ਲੈ ਲਉ ਭਾਅ ਜੀ ਮੇਰਾ ਦੁ ਭਾਅ ਜੀ ਮੇਰਾ ਦਰਦ ਸਮਝੋ ਮੇਰੇ ਅੱਗੇ ਬੜੀ ਦਰਦ ਹੋਣ ਦੀ ਏ ਪਲੀਜ਼ ਚਲੋ ਨਹੀਂ ਜਲਦੀ ਜਲਦੀ ਜਾਣਾ ਜ਼ਰੂਰੀ ਏ ਬਾਅਦ 'ਚ ਡਾਕਟਰ ਵੀ ਚਲਾ ਜੂਗਾ ਚਲੋ ਭਾਅ ਜੀ ਚਲੋ ਜਲਦੀ ਆਓ ਫਿਰ ਜਲਦੀ ਆਓ